ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਤਾਂ ਕਦਰ ਸਮੇਂ ਦੀ ਕਰਦੀ ਹਾਂ ਕਿਉਂਕਿ ਇੱਕ ਵਾਰ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ ਦੂਜੀ ਕਦਰ ਮੈਂ ਆਪਣੇ ਮਾਪਿਆਂ ਦੀ ਕਰਦੀ ਹਾਂ ਕਿਉਂਕਿ ਮਾਪਿਆਂ ਨੇ ਹੀ ਮੈਨੂੰ ਸਮੇਂ ਦੀ ਕਦਰ ਕਰਨਾ ਅਤੇ ਜ਼ਿੰਦਗੀ ਜਿਉਣ ਦਾ ਸਲ ਸਲੀਕਾ ਸਿਖਾਇਆ ਹੈ ਅੱਜ ਜੋ ਕੁਝ ਵੀ ਮੈਂ ਹਾਂ ਆਪਣੀ ਜ਼ਿੰਦਗੀ ਵਿੱਚ ਮੈਂ ਹਾਸਿਲ ਕੀਤਾ ਹੈ ਉਹ ਸਭ ਦੇਣ ਮੇਰੇ ਮਾਪਿਆਂ ਦੀ ਹੈ ਜੋ ਬੰਦਾ ਸਮੇਂ ਦੀ ਕਦਰ ਨਹੀਂ ਕਰਦਾ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਅਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਦੋਨੇ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹਨ